ਹਾਂਜੀ ਹੈਲੋ ਹਾਂਜੀ ਹਾਂਜੀ ਸੱਸ਼ੀਕਾਲ ਜੀ ਸਸ਼ੀਕਾਲ ਹੋਰ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਚਾਹੀਦਾ ਮੈਂ ਹਾਂਜੀ ਹਾਂਜੀ ਠੀਕ ਹੈ ਵਧੀਆ ਬਸ ਤੁਸੀਂ ਸੁਣਾਓ ਬੱਚੇ ਠੀਕ ਹ ਤੇ ਮੈਂ ਕਹਿੰਦੀ ਸੀ ਬਸ ਕੁਝ ਨਹੀਂ ਮੈਂ ਨਹੀਂ ਸੋਚਦੀ ਸੀ ਬਾਜ਼ਾਰ ਚਲੀਏ ਹਾਂ ਉਹ ਤਾਂ ਹੈ ਸਹੀ ਗੱਲ ਆ ਬਹੁਤ ਸ਼ਨੀ ਐਤਵਾਰ ਦਾ ਬਹੁਤ ਖਾਸ ਕਰਕੇ ਭੀੜ ਹੁੰਦੀ ਹੈ ਨਾ ਓਹੀ ਤਾਂ ਜਦੋਂ ਜਾਓ ਹਾਂ ਜਦੋਂ ਵੀ ਜਾਓ ਤੇ ਹੋਰ ਇਕ ਤਾਂ ਉਹੀ ਵਿੱਚ ਛੋਟੀਆਂ ਵੱਡੀਆਂ ਗੱਡੀਆਂ ਸਾਰੀਆਂ ਵੇਖੋ ਵਾਸੇ ਬਾੜ ਬੁੜ ਲੈਂਦੇ ਆ ਤੇ ਉਹਦੇ ਕਰਕੇ ਫਿਰ ਜਿਆਦਾ ਟਰੈਫਿਕ ਜਿਹਾ ਹੋ ਜਾਂਦਾ ਨਾ ਹੁਣ ਇੱਕ ਅੱਜ ਕੱਲ ਜਿਹੜੇ ਉਹ ਆਟ ਬੈਟਰੀ ਵਾਲੇ ਆਟੋ ਜਿਹੇ ਚੱਲੇ ਆ ਉਹਨਾਂ ਨੇ ਤਾਂ ਜਿਆਦਾ ਹੀ ਉਹ ਕੀਤਾ ਪਿਆ ਓ ਉਹ ਤਾਂ ਹਾਂਜੀ ਬਹੁਤ ਜਿਆਦਾ ਉਹ ਤਾਂ ਜਿੱਥੇ ਜੀਅ ਕਰਦਾ ਉੱਥੇ ਹੀ ਵਾੜ ਕੇ ਬਹਿ ਜਾਂਦੇ ਆ ਤੇ ਉਹ ਬਾਕੀ ਪਿੱਛੋਂ ਫਿਰ ਸਾਰਾ ਟ੍ਰੈਫਿਕ ਜਾਮ ਹੋ ਜਾਂਦਾ ਫਿਰ ਦਿੱਕਤਾਂ ਸਭ ਨੂੰ ਆਉਂਦੀਆਂ ਹਨ ਜੀ ਹਾਂਜੀ ਹਾਂਜੀ ਹੋਰ ਨਾ ਕਿਤੇ ਵੀ ਜਾਣਾ ਮੰਨ ਲੋ ਟਾਈਮ ਤੇ ਪਹੁੰਚਿਆ ਹੀ ਨਹੀਂ ਜਾਂਦਾ ਗਾ ਘਰੋਂ ਪੰਦਰਾਂ ਮਿੰਟ ਐਕਸਟਰਾ ਜਾਣਾ ਪੈਂਦਾ ਹਾਂਜੀ ਹਾਂਜੀ ਪੰਦਰਾਂ ਮਿੰਟ ਪਹਿਲਾਂ ਨਿਕਲਣਾ ਪੈਂਦਾ ਵੀ ਹਾਂਜੀ ਹਾਂਜੀ ਹਾਂ ਹਾਂ ਉਹੀ ਤਾਂ ਗੱਲ ਹੁਣ ਕਿਤੇ ਵੀ ਜਾਣਾ ਹੋਵੇ ਨਾ ਪੰਦਰਾਂ ਵੀਹ ਮਿੰਟ ਪਹਿਲਾਂ ਜਾਈਦਾ ਬੱਚਿਆਂ ਨੂੰ ਵੀ ਇਹੀ ਕਹੀਦਾ ਸਕੂਲ ਸਕਾਲ ਜਾਣਾ ਵੀ ਪੰਦਰਾਂ ਮਿੰਟ ਪਹਿਲਾਂ ਜਾਓ ਵੀ ਜਿਹੜਾ ਤੁਸੀਂ ਲੇਟ ਨਾ ਹੋ ਟਰੈਫਿਕ 'ਚ ਫਸਣ ਕਰਕੇ

ਹਾਂ ਹਾਂ ਹਾਂ ਹਾਂ ਹਾਂ ਹਾਂ ਉਦੋਂ ਵੀ ਬਹੁਤ ਹਾਂ ਇੱਕ ਤਾਂ ਬਾਜ਼ਾਰ ਜਾਣਾ ਇੱਕ ਮੇਨ ਟਾਈਮਿੰਗ ਸਵੇਰੇ ਬੱਚਿਆਂ ਦੇ ਸਕੂਲ ਵਾਲੀ ਉਦੋਂ ਨਾ ਜਾਵੇ ਜਾਂ ਛੁੱਟੀ ਟਾਈਮ ਨਾ ਜਾਵੇ ਉਦੋਂ ਤਾਂ ਬਿਲਕੁਲ ਟੱਪਿਆ ਈ ਨੀ ਜਾਂਦਾ ਉੱਥੋਂ ਤਾਂ

ਨਹੀਂ ਲਿਜਾਣਾ ਚਾਹੀਦੇ ਹਾਂ ਹਾਂ ਹਾਂ ਹਾਂ ਇਹਨਾਂ ਨੂੰ ਐ ਹੁਣ ਚਾਹੀਦਾ ਵੀ ਪਾਰਟੀਸ਼ਨ ਜੀ ਕਰਨੀ ਚਾਹੀਦੀ ਵੀ ਉਸ ਰਸਤਾ ਇੱਕ ਅਲੱਗ ਬਾਈਪਾਸ ਟਾਈਪ ਬਣਾਇਆ ਜਾਵੇ ਵੀ ਜਿੱਥੋਂ ਵੱਡੇ ਵਾ ਸਾਧਨ ਚਲੇ ਜਾਣ ਤੇ ਇੱਕ ਪਾਸੋਂ ਆਪਦੇ ਛੋਟੇ ਹਾਂਜੀ ਇਕ ਅੱਜ ਕੱਲ ਲੋਕੀ ਵਿਚੇ ਗੱਡੀਆਂ ਤੇ ਕਿਤੇ ਵੀ ਜਾਣਾ ਤਾਂ ਗੱਡੀਆਂ ਲੈ ਕੇ ਈ ਜਾਣਾ ਬਾਈਕ ਵਗੈਰਾ ਦੀ ਤਾਂ ਹੁਣ ਕੋਈ ਵੈਲਿਊ ਹੀ ਨਹੀਂ ਐ ਤੇ ਉਹ ਉਸੇ ਕਰਕੇ ਜਿਆਦਾ ਟਰੈਫਿਕ ਜਾਮ ਹੋ ਜਾਂਦਾ ਹਾਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਹੋਰ ਚਲੋ ਦੇਖ ਲਾਂਗੇ ਫਿਰ ਆਪਾਂ ਚਲੋ ਨਹੀਂ ਸੈਟਰਡੇ ਸੰਡੇ ਤਾਂ ਫਿਰ ਆਪਾਂ ਹੋਰ ਕਿਸੇ ਦਿਨ ਵਰਕਿੰਗ ਡੇ ਚ ਬਣਾ ਲਾਂਗੇ ਉੱਦਣ ਥੋੜਾ ਜਿਹਾ ਚਲੋ ਹਾਂਜੀ ਹਾਂ ਹਾਂ ਆਪਾਂ ਕਿਸੇ ਵਰਕਿੰਗ ਡੇ 'ਚ ਦੇਖ ਲਾਂਗੇ ਹਨਾ ਚਲੋ ਚਲੋ ਜੀ ਠੀਕ ਆ ਫਿਰ ਹਾਂ ਫਿਰ ਬਣਾਉਦੇ ਪ੍ਰੋਗਰਾਮ ਹਨਾ ਠੀਕ ਠੀਕ ਚਲੋ ਓਕੇ ਓਕੇ ਸੱ